ਸਾਰੇ ਤੁਸੀਂ ਜਾਣਦੇ ਹੋ ਕਿ ਜਿਵੇਂ ਕਿਸਾਨ ਸਾਡੇ ਵਾਸਤੇ ਫਸਲ ਉਗਾਉਂਦਾ ਹੈ ਉਹ ਸਾਡਾ ਮਾਂ ਪਿਓ ਬਣ ਕੇ ਸਾਨੂੰ ਫਸਲ ਦੀ ਫਸਲ ਸਾਨੂੰ ਭੇਜਦਾ ਹੈ ਪਰ ਜਦੋਂ ਉਹਦੇ ਅਹੱਕਾਂ ਦਾ ਨਾ ਹੱਕ ਲੈਣ ਵਾਸਤੇ ਆਉਂਦਾ ਹੈ ਤਾਂ ਉਹ ਉਹਨੂੰ ਸਰਕਾਰ ਦੇ ਨਹੀਂ ਰਹੀ ਉਹਦਾ ਖੁਦਕੁਸ਼ੀ ਦਾ ਕਾਰਨ ਇਹ ਹੈ ਕਿ ਸਰਕਾਰ ਉਹਦੇ ਨਾਲ ਬੇਇਨਸਾਫੀ ਕਰ ਰਹੀ ਹੈ ਕਿਉਂਕਿ ਉਹ ਜਦੋਂ ਵੀ ਹੜ੍ਹ ਆਉਂਦੇ ਨੇ ਜਾਂ ਗੜ੍ਹੇਮਾਰ ਹੁੰਦੀ ਹੈ ਤਾਂ ਉਸ ਦੀ ਫਸਲ ਸਾਰੀ ਖਰਾਬ ਹੋ ਜਾਂਦੀ ਆ ਉਸ ਸਮੇਂ ਵੀ ਕਿਸ ਕਿਸਾਨਾਂ ਦੀ ਬਾਂਹ ਕੋਈ ਵੀ ਨਹੀਂ ਫੜਦਾ ਅਤੇ ਉਹ ਕਿਹੜਾ ਵੈ ਖੁਦਕੁਸ਼ੀ ਦਾ ਕਾਰਨ ਬਣ ਜਾਂਦਾ ਇਸ ਲਈ ਸਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਉ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਜੋ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਪੂਰੀਆਂ ਕਰਨ ਜੋ ਉਹਨਾਂ ਦੇ ਬੱਚਿਆਂ ਦੇ ਹੱਕ ਬਣਦੇ ਨੇ ਉਹਨਾਂ ਨੂੰ ਫੀਸਾਂ ਦੇ ਵਿੱਚ ਮਦਦ ਕਰਨ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਐਡਮਿਸ਼ਨ ਦਿਵਾ ਕੇ ਇਹ ਨਹੀਂ ਕਿ ਉਹਨਾਂ ਨੂੰ ਸਿਰਫ ਪ੍ਰਾਇਮਰੀ ਵਿੱਚ ਸਿੱਖਿਆ ਦੇ ਦਿੱਤੀ ਪਰ ਜਦੋਂ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਵਾਸਤੇ ਬਾਹਰ ਜਾਂਦੇ ਨੇ ਅਤੇ ਉਹਨੂੰ ਕਰਜ਼ਾ ਚੁੱਕ ਕੇ ਬਾਹਰ ਭੇਜਣਾ ਪੈਂਦਾ ਜਦ ਕਿ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਨਾਲ ਮਾਂ ਵਾਲਾ ਪਿਆਰ ਕਰਨ